ਸਾਡੇ ਖੇਤਰ ਵਿੱਚ ਚਾਰ ਸੱਭਿਆਚਾਰਕ ਸਮੂਹ ਰਹਿੰਦੇ ਹਨ ਜਿਹੜੇ ਕਿ ਸਾਨੂੰ ਸੱਭਿਆਚਾਰ ਬਾਰੇ ਪ੍ਰੋਪਰ ਦੱਸਦੇ ਹਨ ਔਰ ਬਾਹਰ ਦੇ ਸੱਭਿਆਚਾਰ ਬਾਰੇ ਜਦੋਂ ਮੈਂ ਕਿਤੇ ਬਾਹਰ ਜਾਂਦਾ ਹਾਂ ਤਾਂ ਉਹਨਾਂ ਦੇ ਰਿਲੇਟਿਡ ਸੱਭਿਆਚਾਰ ਬਾਰੇ ਜਿੰਨੀ ਕੁ ਗੱਲ ਹੁੰਦੀ ਆ ਉਨੀ ਕੁ ਗੱਲ ਕਰਦੇ ਹਾਂ ਜੀ